ਪਰੰਪਰਾਗਤ ਮੌਕਿਆਂ 'ਤੇ ਨੱਚਦੇ ਸਮੇਂ ਲੋਕ ਮੌਕੇ ਅਨੁਸਾਰ ਅਤੇ ਸਥਾਨਕ ਰਵਾਇਤਾਂ ਅਨੁਸਾਰ ਪਹਿਰਾਵਾ ਪਾਉਂਦੇ ਹਨ ਪਹਿਰਾਵਾ ਨੱਚਣ ਦੇ ਢੰਗ 'ਤੇ ਵੀ ਬਹੁਤ ਨਿਰਭਰ ਕਰਦਾ ਹੈ ਜਿਵੇਂ ਕਿ ਪੰਜਾਬ ਵਿੱਚ ਗਿੱਧਾ ਅਤੇ ਭੰਗੜਾ ਬਹੁਤ ਹੀ ਪ੍ਰਸਿੱਧ ਲੋਕ ਨਾਚ ਹੈ ਇਹ ਜ਼ਿਆਦਾਤਰ ਹਰ ਖੁਸ਼ੀ ਦੇ ਮੌਕੇ 'ਤੇ ਜਾਂ ਹਰ ਕਿਸੇ ਤਿਉਹਾਰ 'ਤੇ ਪਾਇਆ ਜਾਂਦਾ ਹੈ ਇਸ ਨੂੰ ਅੰਗਰੇਜ਼ੀ ਵਿੱਚ ਅਸੀਂ ਫੋਕ ਡਾਂਸ ਵੀ ਕਹਿੰਦੇ ਹਾਂ ਗਿੱਧਾ ਪਾਉਣ ਵੇਲੇ ਮੁਟਿਆਰਾਂ ਕੁਝ ਇਸ ਤਰ੍ਹਾਂ ਦੇ ਗਹਿਣੇ ਪਾਉਂਦੀਆਂ ਹਨ ਜਿਵੇਂ ਕਿ ਟਿੱਕਾ ਅਤੇ ਸੱਗੀ ਫੁੱਲ ਪੰਜੇਬਾਂ ਤਵਿਤੜੀਆਂ ਨੱਥ ਜੁਗਨੀ ਆਦਿ ਕੁਝ ਗਹਿਣਿਆਂ ਦੇ ਨਾਮ ਹਨ ਪਹਿਰਾਵਾ ਕੁਝ ਇਸ ਤਰ੍ਹਾਂ ਦਾ ਹੈ ਜਿਵੇਂ ਕਿ ਫੁੱਲਕਾਰੀ ਲਹਿੰਗਾ ਕੁੜਤਾ ਚਾਦਰਾ ਆਦਿ ਭਗਣਾ ਪਾਉਣ ਵੇਲੇ ਭੰਗੜਾ ਪਾਉਣ ਵੇਲੇ ਗੱਭਰੂ ਜੋ ਪਹਿਰਾਵਾ ਪਾਉਂਦੇ ਹਨ ਉਹ ਹੈ ਕੁੜਤਾ ਚਾਦਰਾ ਤੁਰੇ ਵਾਲੀ ਪੱਗ ਜੈਕਟ ਆਦਿ ਅਤੇ ਗਹਿਣੇ ਜਿਵੇਂ ਕੈਂਠਾ ਅਤੇ ਨਥੀਆਂ ਆਦਿ ਪਾਉਂਦੇ ਹਨ